ਹਾਂਜੀ ਲੰਬੀ ਯਾਤਰਾ ਲਈ ਜੀ ਇੱਕ ਤਾਂ ਗੱਡੀ 'ਚ ਤੇਲ ਵਗੈਰਾ ਪੂਰਾ ਹੋਣਾ ਚਾਹੀਦਾ ਜੇ ਅਸੀਂ ਮੋਟਰਸਾਈਕਲ ਵਗੈਰਾ 'ਤੇ ਐਂਂ ਤਾਂ ਸਾਡੇ ਕੋਲ ਹੈਲਮਟ ਹੋਣਾ ਚਾਹੀਦਾ ਤਾਂ ਕਿ ਅਸੀਂ ਦੁਰਘਟਨਾ ਵਗੈਰਾ ਤੋਂ ਬਚ ਸਕੀਏ ਬਾਕੀ ਅਸੀਂ ਲੰਬੀ ਯਾਤਰਾ ਲਈ ਕੁਝ ਖਾਣ ਪੀਣ ਲਈ ਰਸਤੇ 'ਚ ਜੋ ਭੁੱਖ ਵਗੈਰਾ ਨਾ ਲੱਗੇ ਸਮਾਨ ਸਾਡੇ ਕੋਲ ਹੋਣਾ ਬੜਾ ਜ਼ਰੂਰੀ ਹੈ ਉਸ ਤੋਂ ਬਿਨਾਂ ਲੰਬੀ ਯਾਤਰਾ ਦੇ ਨਾਲ਼ ਅਸੀਂ ਆਪਾਂ ਨੂੰ ਚਲਾਉਣ ਸਮੇਂ ਸਾਵਧਾਨੀ ਵਰਤਣੀ ਚਾਹੀਏ ਕੋਈ ਦੁਰਘਟਨਾ ਤੋਂ ਅਸੀਂ ਬਚਦੇ ਰਹੀਏ ਇਹੀ ਮੇਨ ਗੱਲਾਂ ਨੇ ਜੀ